ਮੇਰੀ ਜ਼ਿੰਦਗੀ ਵਿੱਚ ਇੱਕ ਵੱਡੀ ਚੁਣੌਤੀ ਉਦੋਂ ਸਾਹਮਣੇ ਆਈ ਜਦੋਂ ਮੈਂ ਆਪਣੀ ਦਸਵੀਂ ਜਮਾਤ ਪਾਸ ਕੀਤੀ ਅਤੇ ਮੇਰੇ ਘਰਦਿਆਂ ਨੇ ਕਿਹਾ ਕਿ ਬੇਟਾ ਹੁਣ ਆਪਣਾ ਸਕੂਲ ਤੁਸੀਂ ਆਪੇ ਲੱਭੋ ਕਿਉਂਕਿ ਮੈਂ ਨੋਨ ਮੈਡੀਕਲ ਰੱਖਣਾ ਚਾਹੁੰਦਾ ਸੀ ਅਤੇ ਮੇਰੇ ਪੁਰਾਣੇ ਸਕੂਲ ਵਿੱਚ ਨੋਨ ਮੈਡੀਕਲ ਨਹੀਂ ਸੀ ਹੁੰਦੀ ਇਸ ਕਰਕੇ ਮੇਰੇ ਮਾਂ ਪਿਓ ਨੇ ਕਿਹਾ ਕਿ ਆਪਣਾ ਸਕੂਲ ਤੁਸੀਂ ਜਾ ਕੇ ਲੱਭੋ ਅਤੇ ਜਦੋਂ ਮੈਂ ਸਕੂਲ ਲੱਭਣ ਨਿਕਲਿਆ ਤਾਂ ਮੇਰੇ ਘਰ ਦੇ ਨੇੜੇ ਤੇੜੇ ਕੋਈ ਐਦਾਂ ਦਾ ਸਕੂਲ ਨਹੀਂ ਲੱਭਿਆ ਜਿਹਦੇ ਵਿੱਚ ਨੋਨ ਮੈਡੀਕਲ ਸਟਰੀਮ ਹੋਵੇ ਇਸ ਕਰਕੇ ਮੈਨੂੰ ਕਾਫੀ ਭਟਕਣਾ ਪਿਆ ਅਤੇ ਆਪਣੇ ਦੋਸਤਾਂ ਤੋਂ ਬਹੁਤ ਮਦਦ ਲੈਣੀ ਪਈ ਉਹ ਬੜੇ ਦੂਰ ਦੂਰ ਜਾ ਕੇ ਆਪਾਂ ਸਕੂਲ ਲੱਭੇ ਇੱਕ ਸਕੂਲ ਮੈਨੂੰ ਲੱਭਿਆ ਪੱਚੀ ਕਿਲੋਮੀਟਰ ਦੂਰ ਮੇਰੇ ਘਰ ਤੋਂ ਬੜਾ ਦੂਰ ਸੀਗਾ ਅਤੇ ਮੇਰੇ ਘਰਦੇ ਕਹਿੰਦੇ ਕਿ ਬੇਟਾ ਇੰਨੀ ਦੂਰ ਸਕੂਲ ਹੈ ਅਤੇ ਆਪੇ ਹੀ ਜਾਣਾ ਜਿੱਦਾਂ ਮਰਜ਼ੀ ਤੁਸੀਂ ਕਰੋ ਆਪੇ ਦੇਖੋ ਆਪਣੀ ਐਡਮਿਸ਼ਨ ਤੁਸੀਂ ਆਪੇ ਕਰਵਾਓ ਅਤੇ ਇਹ ਮੇਰੀ ਜ਼ਿੰਦਗੀ 'ਚ ਇੱਕ ਬੜੀ ਵੱਡੀ ਪ੍ਰੋਬਲਮ ਸੀਗੀ ਲੇਕਿਨ ਇਸ ਤੋਂ ਬਾਅਦ ਇਹ ਪ੍ਰੋਬਲਮ ਤੋਂ ਬਾਅਦ ਇ ਹੋਰ ਪ੍ਰੋਬਲਮ ਬਹੁਤ ਆਉਣੀਆਂ ਸ਼ੁਰੂ ਹੋਈਆਂ ਜਦੋਂ ਮੈਂ ਗਿਆਰਵੀਂ ਬਾਰਵੀਂ ਕਰ ਲਈ ਉਸ ਤੋਂ ਬਾਅਦ ਮੈਂ ਕੋਲਜ ਵਿੱਚ ਐਡਮਿਸ਼ਨ ਲੈਣੀ ਸੀ ਅਤੇ ਮੇਰੀ ਫੀਸ ਦਾ ਜੁਗਾੜ ਕਰਨਾ ਸੀ ਅਤੇ ਮੇਰੇ ਘਰਦੇ ਕਹਿੰਦੇ ਬੇਟਾ ਹੁਣ ਤੁਸੀਂ ਵੱਡੇ ਹੋ ਗਏ ਹੋ ਕਿ ਆਪਣੀ ਫੀਸ ਜੁਗਾੜ ਆਪੇ ਕਰੋ ਇਸ ਕਰਕੇ ਮੈਂ ਭਾਰਤਪੇ ਨਾਮ ਦੀ ਕੰਪਨੀ ਵਿੱਚ ਜੋਬ ਕੀਤੀ ਸੇਲਸਮੈਨ ਦੀ ਜਿਹਦੇ ਵਿੱਚ ਕਿਊ ਆਰ ਕੋਡ ਲਗਾਉਣੇ ਹੁੰਦੇ ਸੀ ਤਾਂ ਮੈਂ ਕਿਉ ਆਰ ਕਿਊ ਆਰ ਕੋਡ ਲਗਾਉਣ ਲਈ ਦੁਕਾਨਦਾਰਾਂ ਕੋਲ ਜਾਣਾ ਉਹਨਾਂ ਨੂੰ ਮਿੰਨਤਾਂ ਕਰਨੀਆਂ ਰਿਕੁਐਸਟ ਕਰਨੀਆਂ ਪਰ ਉਦੋਂ ਜ਼ਿ ਡਿਜੀਟਲ ਜ਼ਮਾਨਾ ਇੰਨਾ ਹੋਇਆ ਨਹੀਂ ਸੀ ਇਸ ਕਰਕੇ ਉਹਨਾਂ ਨੂੰ ਫਰੋਡ ਲੱਗਦਾ ਸੀ ਇਸ ਲਈ ਉਹਨਾਂ ਨੂੰ ਮਨਾਉਣ ਲਈ ਬਹੁਤ ਤਰਲੇ ਕਰਨੇ ਪੈਂਦੇ ਸੀ ਇਸ ਕਰਕੇ ਇਹ ਬੜੀ ਵੱਡੀ ਚੁਣੌਤੀ ਸੀ ਮੇਰੀ ਜ਼ਿੰਦਗੀ ਵਿੱਚ ਜੋ ਮੈਂ ਪਾਰ ਕੀਤੀ ਹੈ ਅਤੇ ਬੜੇ ਵਧੀਆ ਤਰੀਕੇ ਨਾਲ ਮੈਂ ਟੈਕਲ ਕੀਤਾ ਲੋਕਾਂ ਨੂੰ ਬਹੁਤ ਸਮਝਾਇਆ ਉਹਨਾਂ ਨੂੰ ਇਸ ਕਰਕੇ ਅੱਜ ਮੈਂ ਜ਼ਿੰਦਗੀ ਵਿੱਚ ਬਹੁਤ ਅੱਗੇ ਵੱਧ ਚੁੱਕਿਆ ਅਤੇ ਬਹੁਤ ਖੁਸ਼ ਹਾਂ